ਛੇ ਅਗਸਤ ਉੱਨੀ ਸੌ ਬਾਨਵੇਂ ਪੰਜ ਅਗਸਤ ਉੱਨੀ ਸੌ ਚੁਰਾਨਵੇਂ ਤਿੰਨ ਸਤੰਬਰ ਉੱਨੀ ਸੌ ਨੜ੍ਹਿਨਵੇਂ ਦੋ ਅਗਸਤ ਉੱਨੀ ਸੌ ਨੜਿਨਵੇਂ ਦੋ ਅਕਤੂਬਰ ਦੋ ਹਜ਼ਾਰ ਚਾਰ